ਚਾਹੀਦੇ ਸੀਗੇ ਮੈਂ ਐਮਜੋਨ 'ਤੇ ਗਈ ਅਤੇ ਉਹ ਨਾ ਮੈਨੂੰ ਬੋਜ਼ ਦੇ ਸਪੀਕਰ ਚਾਹੀਦੇ ਸੀਗੇ ਮੈਂ ਐਮਾਜ਼ੋਨ 'ਤੇ ਗਈ ਅਤੇ ਮੈਂ ਉਹਨਾਂ ਦੇ ਪਹਿਲਾਂ ਮੈਂ ਕਲਰ ਦੇਖਿਆ ਕਿ ਮੈਨੂੰ ਕਿੱਦਾਂ ਦਾ ਕਲਰ ਚਾਹੀਦਾ ਮੈਨੂੰ ਬਲੈਕ ਕਲਰ ਚਾਹੀਦਾ ਸੀਗਾ ਮੈਂ ਉਹਨਾਂ ਦੇ ਫਿਰ ਉਹ ਤੋਂ ਬਾਅਦ ਮੈਂ ਉਹਨਾਂ ਦੇ ਰਿਵਿਊਜ਼ ਚੈੱਕ ਕੀਤੇ ਜੋ ਕਿ ਬਹੁਤ ਵਧੀਆ ਸੀਗੇ ਬਹੁਤ ਵਧੀਆ ਕੁਆਲਿਟੀ ਲਿਖੀ ਸੀਗੀ ਔਰ ਉਹਨਾਂ ਦੀ ਬੇਸ ਵਗੈਰਾ ਸਭ ਕੁਝ ਵੋਲਿਊਮ ਅਪ ਡਾਊਨ ਸਾਰੇ ਕੀ ਕਹਿੰਦੇ ਆ ਬਹੁਤ ਵਧੀਆ ਸੀਗੀ ਠੀਕ ਹੈ ਉਹ ਤੋਂ ਬਾਅਦ ਮੈਂ ਉਹਨਾਂ ਦਾ ਪ੍ਰਾਈਸ ਚੈੱਕ ਕੀਤਾ ਜੋ ਕਿ ਬਹੁਤ ਹੀ ਜ਼ਿਆਦਾ ਵਧੀਆ ਸੀਗਾ ਠੀਕ ਸੀਗਾ ਪ੍ਰਾਈਜ ਮੈਂ ਉਹਨਾਂ ਦਾ ਪ੍ਰਾਈਜ ਚੈੱਕ ਕੀਤਾ ਅਤੇ ਉਹ ਠੀਕ ਸੀਗਾ ਅਤੇ ਉਹਨਾਂ ਨੂੰ ਮੈਂ ਆਰਡਰ ਕਰ ਦਿੱਤਾ ਬਿਨਾਂ ਸੋਚੇ ਸਮਝੇ ਮੈਂ ਆਰਡਰ ਕਰ ਦਿੱਤਾ ਅਤੇ ਉਹਨਾਂ ਦੀ ਡਿਲੀਵਰੀ ਮੈਨੂੰ ਤਿੰਨ ਦਿਨਾਂ ਬਾਅਦ ਹੀ ਮਿਲ ਗਈ ਹੈ ਔਰ ਮੈਂ ਉਹਨਾਂ ਨੂੰ ਯੂਜ ਕਰਕੇ ਦੇਖਿਆ ਉਹ ਬਹੁਤ ਵਧੀਆ ਆ ਔਰ ਮੈਂ ਉਹਨਾਂ ਨੂੰ ਬਾਰ ਬਾਰ ਉਹਨਾਂ ਦੇ ਉੱਤੇ ਗਾਣੇ ਲਗਾ ਕੇ ਬਲੂਟੁੱਥ ਰਾਹੀਂ ਬਹੁਤ ਸੁਣਦੀ ਹਾਂ ਐਂਡ ਅਤੇ ਮੈਂ ਆਂਢ ਗੁਆਂਢ ਦੇ ਵਿੱਚ ਵੀ ਆਪਣੇ ਜੋ ਉਹਨਾਂ ਨੂੰ ਕਹਿੰਦੀ ਆ ਕਿ ਐਮਜੋਨ ਤੋਂ ਹੀ ਬੋਜ਼ ਦੇ ਜੋ ਹੈਗੇ ਨੇ ਹੈਡ ਸਪੀਕਰ ਨੇ ਉਹੀ ਲਗਾਉਣ ਜੋ ਵਿਆਹ ਸ਼ਾਦੀਆਂ ਦੇ ਉੱਤੇ ਜੋ ਘਰ ਦੇ ਵਿੱਚ ਫੰਕਸ਼ਨ ਆ ਜਾਂ ਫਿਰ ਕੁਝ ਵੀ ਹੈਗਾ ਤੁਹਾਡਾ ਤੁਸੀਂ ਬਰਥਡੇ ਸੈਲੀਬਰੇਟ ਕਰਦੇ ਹੋ ਉਹਨਾਂ ਦੇ ਉੱਤੇ ਤੁਸੀਂ ਸਪੀਕਰ ਲਾ ਕੇ ਉਹਨਾਂ ਦੇ ਉੱਤੇ ਗਾਣੇ ਲਗਾ ਸਕਦੇ ਹੋ ਜਾਂ ਭਜਨ ਸੁਣ ਸਕਦੇ ਹੋ ਕੁਛ ਵੀ ਸੁਣ ਸਕਦੇ ਹੋ ਤਾਂ ਉਹਨਾਂ ਦੀ ਕੁਆਲਟੀ ਬਹੁਤ ਵਧੀਆ ਮੈਂ ਸਾਰਿਆਂ ਨੂੰ ਕਹੂੰਗੀ ਕਿ ਆਹੀ ਕੀ ਕਹਿੰਦੇ ਆ ਬੋਜ਼ ਦੇ ਸਪੀਕਰ ਜੋ ਹੈਗੇ ਨੇ ਸਭ ਕੋ ਬੈਸਟ ਕੁਆਲਿਟੀ ਆ ਮੈਂ ਉਹਨਾਂ ਦੇ ਰਿਵਿਊਜ਼ ਵੀ ਬਹੁਤ ਵਧੀਆ ਦਿੱਤੇ ਨੇ ਅਤੇ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਉਹਨਾਂ ਨੂੰ ਮੈਂ ਅਗਰ ਆਹ ਇਹਨਾਂ ਦੀ ਉਹਨਾਂ ਦੀ ਦੋ ਸਾਲ ਦੀ ਵਾਰੰਟੀ ਵੀ ਹੈਗੀ ਆ ਜੋ ਮੈਂ ਉਹਨਾਂ ਨੂੰ ਕਿਹਾ ਕਿ ਅਗਰ ਵੱਧ ਪੈਸੇ ਦੇ ਕੇ ਮੈਂ ਉਹਨਾਂ ਦੀ ਵਰੰਟੀ ਐਕਸਟੈਂਡ ਵੀ ਕਰਵਾ ਸਕਦੀ ਹਾਂ